ਹੈਲੋ ਮੈਂ ਸ਼ਿੰਦਰਪਾਲ ਕੌਰ ਪਿੰਡ ਫਾਫੜੇ ਭਾਈਕੇ ਤੋਂ ਹਾਂ ਮੈਂ ਮੈਂ ਕੱਲ੍ਹ ਇੱਕ ਕੈਬ ਬੁੱਕ ਕਰੀ ਸੀ ਮੈਂ ਅੱਜ ਫਾਫੜੇ ਭਾਈਕੇ ਤੋਂ ਦਿੱਲੀ ਜਾਣਾ ਸੀ ਜਿਸ ਲਈ ਮੈਂ ਪਹਿਲਾ ਹੀ ਕੈਬ ਬੁੱਕ ਕਰਕੇ ਅਡਵਾਂਸ ਵਿੱਚ ਅੱਧੇ ਪੈਸੇ ਦਿੱਤੇ ਸੀ ਪਰ ਅੱਜ ਮੌਸਮ ਬਹੁਤ ਹੀ ਖਰਾਬ ਹੈ ਮੀਂਹ ਬਹੁਤ ਹੀ ਜ਼ਿਆਦਾ ਪੈ ਰਿਹਾ ਹੈ ਇਸ ਲਈ ਮੇਰਾ ਜਾਣਾ ਕੈਂਸਲ ਹੋ ਗਿਆ ਹੈ ਇਸ ਲਈ ਮੈਂ ਕੈਬ ਰੱਦ ਕਰਨਾ ਚਾਹੁੰਦੀ ਹਾਂ ਅਤੇ ਮੇਰੇ ਪਹਿਲਾਂ ਦਿੱਤੇ ਹੋਏ ਪੈਸੇ ਵੀ ਮੇਰੇ ਅਕਾਂਊਟ ਵਿੱਚ ਦੁਬਾਰਾ ਪਾ ਦਿਓ ਮੈਂ ਆਪ ਦੀ ਧੰਨਵਾਦੀ ਹੋਵਾਂਗੀ ਅੱਜ ਮੇਰਾ ਜਾਣਾ ਸਮੇਂ 'ਤੇ ਹੀ ਕੈਂਸਲ ਹੋ ਗਿਆ ਇਸ ਲਈ ਜਲਦੀ ਤੋਂ ਜਲਦੀ ਪੈਸੇ ਵਾਪਸ ਪਾ ਦਿਓ ਧੰਨਵਾਦ